ਭੰਗੜਾ ਐਰੋਬਿਕਸ ਵਿੱਚ ਰਵਾਇਤੀ ਭੰਗੜਾ ਡਾਂਸ ਦੇ ਤੱਥਾਂ ਨੂੰ ਸ਼ਾਮਿਲ ਕਰਨ ਲਈ ਅਸੀਂ ਭੰਗੜੇ ਦੀਆਂ ਮੁੱਲ ਹਲਚਲਾਂ ਨੂੰ ਐਰੋਬਿਕਸ ਦੀ ਤਕਨੀਕ ਨਾਲ ਮਿਲਾ ਕੇ ਇੱਕ ਉਤਸ਼ਾਹ ਭਰੀ ਰੂਟੀਨ ਤਿਆਰ ਕਰਦੇ ਹਾਂ ਇਹ ਰੂਟੀਨ ਵਿੱਚ ਤੀਬਰਤਾ ਵਾਲੀ ਰਿਕਾਰਡਿੰਗ ਐਕਸੋਸਾਈਜ ਅਤੇ ਹੱਸੇ ਵੱਜੋਂ ਕੰਮ ਕਰਦੀ ਹੈ ਜੋ ਕਿ ਸਰੀਰ ਦੀ ਫਿਟਨੈਸ ਅਤੇ ਸੈਟੇ ਮੀਨਾ ਸਟੋਮੀਨਾ ਵਧਾਉਣ ਵਿੱਚ ਮਦਦ ਕਰਦੀ ਹੈ ਵੋਮਅਪ ਪੰਜ ਤੋਂ ਦਸ ਮਿੰਨਟ ਹਲਕਾ ਜੋਗਿੰਗ ਸਰੀਰ ਨੂੰ ਗਰਮ ਕਰਨ ਲਈ ਰਵਾਇਤੀ ਭੰਗੜੇ ਦੀਆਂ ਤਾਲੀਆਂ ਹੱਥ ਉੱਪਰ ਚੁੱਕ ਕੇ ਹੌਲੀ ਹੌਲੀ ਤਾਲੀ ਮਾਰਨਾ ਕੰਧਿਆਂ ਦੀ ਹਰਕਤ ਭੰਗੜੇ ਤੇ ਆਮ ਪਾਸੇ ਸਕਾ ਲੈ ਕੇ ਹੋਲੀ ਹੌਲੀ ਥੁਮਕਾ ਜਿਨਾ ਤਿਬਤੇ ਹੋਏ ਸਰੀਰ ਨੂੰ ਢਿਲਾ ਛੱਡਣਾ ਹਾਈ ਇੰਟੋਸਿਟੀ ਭੰਗੜਾ ਐਰੋਬਿਕ ਰੂਟੀਨ ਵੀਹ ਤੋਂ ਤੀਹ ਮਿੰਟ ਝੂਮਰ ਲੋ ਇੰਪੈਕਟ ਹੱਥ ਹੌਲੀ ਹੌਲੀ ਹਿਲਾਉਣੇ ਪੈਰ ਆਸਮਾਨ